ਹੈਲੋ ਹਾਂਜੀ ਵਧੀਆ ਦੀਦੀ ਠੀਕ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਦੀਦੀ ਹਾਂਜੀ ਉਹ ਨਾ ਬਸ ਦੀਦੀ ਸਾਡੀ ਇਹਨਾਂ ਦੀ ਜੋਬ ਓਹ ਬਦਲੀ ਹੋ ਗਈ ਸੀਗੀ ਅਤੇ ਹਾਂਜੀ ਫ਼ਿਰੋਜ਼ਪੁਰ ਵਿੱਚ ਆ ਰਹੇ ਹਾਂ ਅਤੇ ਸਾਨੂੰ ਸ਼ਹਿਰ ਬਾਰੇ ਕੁਛ ਜ਼ਿਆਦਾ ਨਹੀਂ ਪਤਾ ਅਤੇ ਕਿਉਂਕਿ ਅੱਗੇ ਰਹੇ ਹਾਂ ਬਹੁਤ ਸਾਲ ਪਰ ਹੁਣ ਚੇਂਜ ਬਹੁਤ ਹੋ ਗਿਆ ਹੈ ਅਤੇ

ਹਾਂ ਹਾਂਜੀ ਤਾਂ ਹੁਣ ਤੁਸੀਂ ਮੈਨੂੰ ਮਾੜਾ ਜਿਹਾ ਦੱਸ ਦੇਣਾ ਇਹਦੇ ਬਾਰੇ ਹਾਂਜੀ ਠੀਕ ਹੈ ਦੀਦੀ ਮੈਨੂੰ ਨਾ ਤਾਜ਼ਾ ਸਬਜ਼ੀ ਖਾਣ ਦੀ ਆਦਤ ਹੈ ਕਿਉਂਕਿ ਇੱਥੇ ਰੇਹੜੀ ਵਾਲੇ ਤੇ ਬਹੁਤ ਆਉਂਦੇ ਨੇ ਪਰ ਉਹਨਾਂ ਕੋਲ ਨਾ ਤਾਜ਼ਾ ਸਬਜ਼ੀ ਨਹੀਂ ਮਿਲਦੀ ਗੀ ਹਾਂਜੀ ਹਾਂਜੀ ਸਬਜ਼ੀ ਵਗੈਰਾ ਫਰੂਟ ਵਗੈਰਾ ਸਾਨੂੰ ਚਾਹੀਦਾ ਹੁੰਦਾ ਤਾਜ਼ਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਕਿਉਂਕਿ ਬੱਚੇ ਛੋਟੇ ਆ ਡਾਕਟਰ ਨੇ ਕਿਹਾ ਵੀ ਤਾਜ਼ਾ ਦੁੱਧ ਬੱਚਿਆਂ ਨੂੰ ਲੈ ਕੇ ਦੇਣਾ ਹੈ ਇਹਨਾਂ ਨੂੰ ਇਹ ਹੀ ਪਿਆਉਣਾ ਤੁਸੀਂ ਮੈਨੂੰ ਦੱਸ ਦੇਣਾ ਡੇਰੀ ਫਾਰਮ ਕਿੱਥੋਂ ਵੀ ਜਿੱਥੋਂ ਮਿਲੇਗਾ ਤਾਜ਼ਾ ਦੁੱਧ ਫਿਰ ਮੈਂ ਉਥੋਂ ਬੱਚਿਆਂ ਵਾਸਤੇ ਦੁੱਧ ਲੈ ਆਇਆ ਕਰਾਂਗੀ ਹਾਂਜੀ ਹਾਂਜੀ ਠੀਕ ਹੈ ਜੀ ਆਪਣੇ ਇੱਥੇ ਫ਼ਿਰੋਜ਼ਪੁਰ ਵਿੱਚ ਮੰਨ ਲਓ ਜਿਵੇਂ ਆਪਾਂ ਸ਼ੋਪਿੰਗ ਕਰਨੀ ਹੋਵੇ ਮਾਰਕੀਟ ਵਿੱਚ ਕੋਈ ਵੀ ਸਮਾਨ ਲੈਣਾ ਹੋਵੇ ਸੂਟ ਵਗੈਰਾ ਜਾਂ ਕੋਈ ਜੂਲਰੀ ਵਗੈਰਾ ਕੁਛ ਵੀ ਲੈਣਾ ਹੋਵੇ ਤਾਂ ਮੈਨੂੰ ਥੋੜ੍ਹਾ ਜਿਹਾ ਹਾਂਜੀ ਹਾਂਜੀ ਠੀਕ ਐ ਜੀ ਠੀਕ ਐ ਜੀ ਠੀਕ ਐ ਜੀ ਹਾਂਜੀ ਕੋਈ ਗੱਲ ਨਹੀਂ ਅਸੀਂ ਨਾ ਫ਼ਿਰੋਜ਼ਪੁਰ ਅੱਜ ਹੀ ਆਏ ਸੀ ਸਮਾਨ ਰੱਖ ਰਹੇ ਸੀਗੇ ਅਤੇ ਮੇਰਾ ਥੋੜ੍ਹਾ ਬਹੁਤਾ ਸਮਾਨ ਲੈਣ ਵਾਲਾ ਹੈ ਅਤੇ ਮੈਂ ਤੁਹਾਨੂੰ ਦੱਸ ਦੇਵਾਂਗੀ ਫਿਰ ਤੁਸੀਂ ਮੇਰੇ ਨਾਲ ਚਲੇ ਜਾਣਾ ਅਤੇ ਮੈਂ ਆਪਣੀ ਸ਼ੋਪਿੰਗ ਠੀਕ ਹੈ ਜੀ ਹਾਂਜੀ ਕੋਈ ਗੱਲ ਨਹੀਂ ਮੈਂ ਜੇ ਆਪਣੀ ਰਸੋਈ ਦਾ ਸਮਾਨ ਵੀ ਸਾਰਾ ਲੈਣਾ ਹੈ ਤੇ ਬਾਕੀ ਸਾਰਾ ਸਮਾਨ ਵੀ ਕੱਪੜਾ ਵਗੈਰਾ ਸਾਰਾ ਕੁਛ ਜਿਵੇਂ ਇਹਨਾਂ ਬੱਚਿਆਂ ਵਾਸਤੇ ਵੀ ਲੈਣਾ ਹੈ ਸਮਾਨ ਲੈਣਾ ਤੁਸੀਂ ਮੈਨੂੰ ਹਿਸਾਬ 'ਤੇ ਦੱਸ ਦੇਣਾ ਫਿਰ ਮੈਂ ਤੁਹਾਨੂੰ ਨਾਲ ਲੈ ਚੱਲਾਂਗੀ ਹਾਂਜੀ ਹਾਂਜੀ ਵਧੀਆ ਠੀਕ ਠਾਕ ਨੇ ਹਾਂਜੀ ਵਧੀਆ ਵਧੀਆ ਠੀਕ ਠਾਕ ਤੁਸੀਂ 'ਤੇ ਸੁਣਾਓ ਹਾਂਜੀ ਅਤੇ ਤੁਸੀਂ ਦੀਦੀ ਇੱਕ ਵਾਰ ਆ ਜਿਓ ਮੇਰੇ ਕੋਲ ਅਤੇ ਮੈਨੂੰ ਉੱਥੋਂ ਦਾ ਜਿਹੜਾ ਰਿਸਪੋਂਸ ਮਿਲ ਜਾਏਗਾ ਮੇਰੀ ਥੋੜ੍ਹੀ ਜਿਹੀ ਹੈਲਪ ਹੋ ਜਾਏਗੀ

ਹਾਂਜੀ ਫ਼ਿਰੋਜ਼ਪੁਰ ਵਿੱਚ ਹੀ ਆਈ ਹੈ ਹਾਂਜੀ ਅਤੇ ਇੱਥੇ ਦਾ ਆਪਣੇ ਦਾ ਕੋਈ ਹੋਰ ਵੀ ਕੋਈ ਚੀਜ਼ ਵਧੀਆ ਚੀਜ਼ ਇੱਥੇ ਜਿਹੜੀ ਹੋਵੇ ਜਿਹੜੀ ਆਪਾਂ ਮਨ ਲਓ ਕਿ ਅੱਗੇ ਨਾ ਦੇਖੀ ਹੋਵੇ ਹਾਂਜੀ ਠੀਕ ਹੈ ਜੀ ਹਾਂਜੀ ਮੈਂ ਨਾ ਇੱਕ ਵਾਰ ਘਰ ਦੀ ਸਾਰੀ ਸੈਟਿੰਗ ਕਰਕੇ ਫਿਰ ਮੈਂ ਤੁਹਾਨੂੰ ਕਾਲ ਕਰਾਂਗੀ ਫਿਰ ਆਪਾਂ ਇੱਕ ਚੱਲਾਂਗੇ ਨਾਲੇ ਖਾਲਸਾ ਗੁਰਦੁਆਰਾ ਦੇਖ ਕੇ ਆਵਾਂਗੇ ਅਤੇ ਫਿਰ ਨਾਲੇ ਆਪਾਂ ਬਾਰਡਰ ਵੀ ਵੇਖ ਕੇ ਆਵਾਂਗੇ ਸਾਰਾ ਫਿਰ ਫਿਰੋਜ਼ਪੁਰ ਹਾਂਜੀ ਹਾਂਜੀ ਫਿਰ ਹਾਂਜੀ ਹਾਂਜੀ ਫਰੀ ਹੋ ਕੇ ਫਿਰ ਸੈਟਿੰਗ ਕਰਕੇ ਤੁਹਾਨੂੰ ਮੈਂ ਸਾਰਾ ਕੁਛ ਦੱਸ ਦਿਆਂਗੀ ਅਤੇ ਫਿਰ ਤੁਹਾਨੂੰ ਮੈਂ ਕਾਲ ਕਰ ਦੇਵਾਂਗੀ ਅਤੇ ਤੁਸੀਂ ਮੇਰੇ ਕੋਲ ਹੀ ਆ ਜਾਣਾ ਫਿਰ ਆਪਾਂ ਇਕੱਠੇ ਚੱਲਾਂਗੇ ਨਾਲੇ ਮੈਨੂੰ ਮਾਰਕੀਟ ਵਗੈਰਾ ਦਾ ਸਾਰਾ ਪਤਾ ਲੱਗ ਜਾਏਗਾ ਹਾਂਜੀ ਠੀਕ ਹੈ ਜੀ ਧੰਨਵਾਦ